ਬਿਜਲੀ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਹੀ ਜਰ ਅ ਜ਼ਰੂਰੀ ਅੰਗ ਇੱਕ ਬਣ ਚੁੱਕੀ ਹੈ ਜਿਸ ਵਿੱਚ ਕਿ ਇਸਦੇ ਬਹੁਤ ਹੀ ਲਾਭ ਅਤੇ ਬਹੁਤ ਹੀ ਹਾਨੀਆਂ ਹੁੰਦੀਆਂ ਹਨ ਜਿਵੇਂ ਕਿ ਬਿਜਲੀ ਕੀ ਇੱਕ ਪ੍ਰਕਾਰ ਦਾ ਸਾਡਾ ਇੱਕ ਹੁਣ ਅੰਗ ਬਣ ਗਿਆ ਹੈ ਇਸ ਨਾਲ ਅਸੀਂ ਬਹੁਤ ਹੀ ਜ਼ਰੂਰੀ ਕੰਮ ਕਰਦੇ ਜਿਵੇਂ ਕਿ ਫੋਨ ਚਾਰਜ ਕਰਨਾ ਅਤੇ ਹੋਰ ਇਲੈਕਟਰੀਕੁਲ ਇਲੈਕਟਰੀਕਲ ਚੀਜ਼ਾਂ ਅਸੀਂ ਯੂਜ਼ ਕਰਦੇ ਹਾਂ ਇਹਦੇ ਵਿੱਚ ਯੂਜ਼ ਕਰਕੇ ਅਤੇ ਜਿਸ ਕਾਰਨ ਕਿ ਹੁਣ ਇਹ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਜ਼ਰੂਰੀ ਹੀ ਇੱਕ ਅੰਗ ਹੈ ਇਸ ਲਈ ਬਿਜਲੀ ਦੀ ਜੇ ਲਾਭ ਹਨ ਤਾਂ ਇਸ ਨਾਲ ਇਸ ਦੀਆਂ ਹਾਨੀਆਂ ਵੀ ਬਹੁਤ ਹਨ ਜਿਵੇਂ ਕਿ ਹੁਣ ਅਸੀਂ ਕਿ ਬਿਜਲੀ ਨਾਲ ਜੇ ਪਾਣੀ ਥੋੜ੍ਹਾ ਅਟੈਚ ਹੋ ਜਾਵੇ ਅਤੇ ਇਸ ਨਾਲ ਸਾਨੂੰ ਬਿਜਲੀ ਲੱਗਣ ਦਾ ਖ਼ਤਰਾ ਬਹੁਤ ਹੈ ਸਾਡੀ ਜਾਨ ਜਾਣ ਦਾ ਖ਼ਤਰਾ ਬਹੁਤ ਹੈ ਘਰ ਵਿੱਚ ਅੱਗ ਲੱਗਣ ਦਾ ਬਹੁਤ ਖ਼ਤਰਾ ਹੈ ਠੀਕ ਹੈ ਅਤੇ ਇਸ ਨੂੰ ਅਸੀਂ ਉਹ ਸਹੀ ਵਰਤੋਂ ਨਾਲ ਸ ਸਹੀ ਢੰਗ ਨਾਲ ਅਸੀਂ ਜੇ ਇਸ ਨੂੰ ਵਰਤੋਂ ਕਰੀਏ ਇਸ ਤਾਂ ਇਹ ਸਾਡੇ ਲਈ ਲਾਭਦਾਇਕ ਹੈ ਇਸ ਲਈ ਬਿਜਲੀ ਜ਼ਿਆਦਾ ਨੁਕਸਾਨ ਵੀ ਨਹੀਂ ਕਰਨਾ ਚਾਹੀਦਾ ਹੈ ਜ਼ਿਆਦਾ ਲਾਭ ਲਾਭ ਲੈਣੇ ਚਾਹੀਦੇ ਸਾਨੂੰ ਵੱਧ ਤੋਂ ਵੱਧ ਲਾਭ ਲਓ ਬਿਜਲੀ ਦੇ ਜਿੰਨੇ ਲਾਭ ਲੈ ਸਕੋ ਅਤੇ ਇਸ ਦੇ ਲਾਭ ਤਾਂ ਹੋਰ ਬਹੁਤ ਨੇ ਜਿਵੇਂ ਕਿ ਹੁਣ ਅਸੀਂ ਜਿੰਨੇ ਵੀ ਇਲੈਕਟਰੀਕਲ ਚੀਜ਼ਾਂ ਅਸੀਂ ਯੂਜ਼ ਕਰਦੇ ਹਨ ਇਸ ਵਿੱਚ ਜ਼ਿਆਦਾ ਯੂਜ਼ ਬਿਜਲੀ ਦਾ ਹੀ ਹੁੰਦਾ ਹੈ ਅਤੇ ਹੁਣ ਅਸੀਂ ਬਿਜ ਬਿਜਲੀ ਦੇ ਨੁਕਸਾਨ ਵੀ ਸਾਨੂੰ ਬਹੁਤ ਹੋ ਰਹੇ ਹਨ ਜਿਵੇਂ ਕਿ ਪੰਛੀ ਮਰਦੇ ਹਨ ਬਿਜਲੀ ਦੇ ਖੰਭਿਆਂ ਪਰ ਲਗ ਕੇ ਪੰਛੀ ਮਰ ਜਾਂਦੇ ਹਨ ਕਈ ਵਾਰ ਹੜ੍ਹ ਆਉਂਦੇ ਹਨ ਕੋਈ ਕੋਈ ਫਲੱਡ ਆਉਂਦਾ ਹੈ ਕੋਈ ਭੁਚਾਲ ਆਉਂਦਾ ਹੈ ਕੋਈ ਤੁਫ਼ਾਨ ਆਉਂਦਾ ਹੈ ਜਿਸ ਨਾਲ ਬਿਜਲੀ ਦੇ ਖੰਭੇ ਗਿਰਦੇ ਹਨ ਅਤੇ ਕਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ